ਹਾਂਜੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਤਾਂ ਹਮੇਸ਼ਾ ਥੋੜ੍ਹੀ ਬਹੁਤੀ ਕਮੀਆਂ ਰਹਿੰਦੀਆਂ ਹੀ ਪਰ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਮੋਹਾਲੀ ਵਿੱਚ ਵੀ ਛੇ ਫੇਸ ਵਾਲੇ ਹੋਸਪਿਟਲ ਵਿੱਚ ਅੱਗੇ ਨਾਲੋਂ ਬਹੁਤ ਜ਼ਿਆਦਾ ਅੱਛਾ ਹੋ ਗਿਆ ਪਹਿਲਾਂ ਬੜਾ ਡਾਕਟਰ ਬੜੇ ਘੱਟ ਸੀ ਹੁਣ ਠੀਕ ਹੈ ਫੇਰ ਵੀ ਪਹਿਲਾਂ ਨਾਲੋਂ ਅਤੇ ਬਾਕੀ ਪਬਲਿਕ ਦੇ ਐਕੋਰਡਿੰਗ ਹੋਰ ਬਿਹਤਰ ਹੋਣਾ ਚਾਹੀਦਾ ਹੈ ਅਤੇ ਅੱਗੇ ਨੂੰ ਵੈਸੇ ਮਸ਼ੀਨਾਂ ਵਧੀਆ ਆ ਗਈਆਂ ਪਹਿਲਾਂ ਨਾਲੋਂ ਉਹਨਾਂ ਦਾ ਇਲਾਜ ਛੇਤੀ ਹੋ ਜਾਂਦਾ ਹੈ ਜਿਵੇਂ ਪੇਸ਼ੈਂਟ ਆਉਂਦੇ ਹੈ ਜਿਹੜੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਡਾਕਟਰ ਗਾਈਡ ਕਰਦੇ ਹੈ ਦੇਖਦੇ ਹੈ ਦਵਾਈਆਂ ਅੱਛੀਆਂ ਲਿਖਦੇ ਹੈ ਪਰ ਫੇਰ ਵੀ ਘਾਟ ਤਾਂ ਰਹਿੰਦੀ ਉਹ ਹੀ ਹੈ ਡਾਕਟਰਾਂ ਦੀ ਅਤੇ ਕੋਵਿਡ ਦਾ ਜੋ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਕੋਈ ਕਈਆਂ ਦੇ ਰਿਸ਼ਤੇਦਾਰ ਬੇਚਾਰੇ ਹੋ ਗਏ ਹੈ ਦੇਖਭਾਲ ਤੋਂ ਬਿਨਾਂ ਅਤੇ ਸਿਹਤ ਲਈ ਹੋਰ ਅੱਛੇ ਸੁਧਾਰ ਹੋ ਜਾਣ ਤਾਂ ਬਹੁਤ ਵਧੀਆ ਹੈ